ਮੈਂ ਰੋ ਰੋਜ਼ ਰਨਿੰਗ ਆਪਣੇ ਭਰਾ ਅਤੇ ਆਪਣੇ ਦੋਸਤਾਂ ਨਾਲ ਕਰਦਾ ਹਾਂ ਇਹ ਖੇਡ ਸਾਡੇ ਵੈਸ਼ਾਲੀ ਸ਼ਾਲੀਮਰ ਬਾਗ ਵਿੱਚ ਬਣੀ ਹੈ ਬਹੁਤ ਜ਼ਿਆਦਾ ਲੋਕ ਰਨਿੰਗ ਕਰਦੇ ਹਨ ਇਸ ਨਾਲ ਲੋਕ ਫਿੱਟ ਬਹੁਤ ਰ ਫਿੱਟ ਬਹੁਤ ਰਹਿੰਦੇ ਹਨ ਅਤੇ ਫਾਇਨ ਵੀ ਬਹੁਤ ਰਹਿੰਦੇ ਹਨ ਉਹ ਬਹੁਤ ਤੇਜ਼ ਜ਼ਿਆਦਾ ਦੌੜਦੇ ਹਨ ਅਤੇ ਉਹਨਾਂ ਨੂੰ ਸਿਹਤ ਸਾਹ ਵੀ ਬਹੁਤ ਘੱਟ ਚੜਦਾ ਹੈ ਅਤੇ ਉਹ ਜ਼ਿਆਦਾਤਰ ਘੱਟ ਘੱਟ ਤਲਿਆ ਖਾ ਤਲਿਆ ਘੱਟ ਖਾਂਦੇ ਹਨ ਅਤੇ ਬਹੁਤ ਬਹੁਤ ਜ਼ਿਆਦਾ ਫਿੱਟ ਰਹਿੰਦੇ ਹਨ ਸਾਨੂੰ ਵੀ ਸਾਨੂੰ ਵੀ ਹੋਰ ਖੇਡਾਂ ਖੇਡਣੀਆਂ ਚਾਹੀਦੀਆਂ ਹਨ ਪਰ ਰਨਿੰਗ ਜ਼ਰੂਰ ਕਰਨੀ ਚਾਹੀਦੀ ਹੈ ਰਨਿੰਗ ਅਤੇ ਸੈਰ ਕਰਨ ਨਾਲ ਸਾਡਾ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਸਾਨੂੰ ਤਾਜ਼ੀ ਹਵਾ ਪ੍ਰਾਪਤ ਹੁੰਦੀ ਹੈ ਸਾ ਬਾਗ ਸਾਡੇ ਬਾਗ ਵਿੱਚ ਬਹੁਤ ਜ਼ਿਆਦਾ ਲੋਕ ਰਨਿੰਗ ਅਤੇ ਸੈਰ ਬਹੁਤ ਜ਼ਿਆਦਾ ਕਰਦੇ ਹਨ ਸਾਨੂੰ ਹੋਰ ਖੇਡਾਂ ਨੂੰ ਖੇਡਣ ਨਾਲੋਂ ਪਹਿਲਾਂ ਸਾਨੂੰ ਰਨਿੰਗ ਬਹੁਤ ਕਰਨੀ ਚਾਹੀਦੀ ਹੈ ਇਸ ਨਾਲ ਬੱਚੇ ਜਾਂ ਬੱਚੇ ਜਾਂ ਬੁੱਢੇ ਸਭ ਤੰਦਰੁਸਤ ਰਹਿੰਦੇ ਹਨ ਅਤੇ ਹੋਰ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਹਨ ਅਤੇ ਤੁਸੀਂ ਕ ਕਿਸੇ ਨਾਲ ਲੋਕ ਲਈ ਉਹ ਖੇਡ ਇੱਥੇ ਜਗ੍ਹਾ ਸ਼ਾਲੀਮਰ ਬਾਗ ਵਿੱਚ ਬਣੀ ਹੈ ਅਤੇ ਬਹੁਤ ਜ਼ਿਆਦਾ ਲੋਕ ਇੱਥੇ ਖੇਡਦੇ ਹਨ ਸਾਨੂੰ ਸਾਨੂੰ ਖੇਡਾਂ ਨੂੰ ਪ੍ਰਭਾਵਿਤ ਕਰਨਾ ਚਾਹੀਦਾ ਹੈ ਨਾ ਕਿ ਸਾਨੂੰ ਮੋਬਾਇਲ ਜਾਂ ਹੋਰ ਕਿਸੇ ਚੀਜ਼ ਨਾਲ ਛੇੜਨਾ ਛੇੜ ਛਾੜ ਕਰਨੀ ਚਾਹੀਦੀ ਹੈ ਸਾਨੂੰ ਰਨਿੰਗ ਬਹੁਤ ਜ ਰੋਜ਼ ਕਰਨੀ ਚਾਹੀਦੀ ਹੈ